ਭੋਜਨ ਨਾਲ ਸੰਬੰਧਿਤ ਹਰ ਮਨੁੱਖ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦੀ ਐਲਰਜੀ ਹੁੰਦੀ ਹੈ ਜਿਹਨੂੰ ਉਹ ਪਸੰਦ ਨਹੀਂ ਕਰਦਾ ਕਈ ਵਾਰ ਸਾਡੇ ਹੱਥ ਜਾਂ ਸਾਡੀ ਚਮੜੀ 'ਤੇ ਇਸ ਤਰ੍ਹਾਂ ਦੇ ਸਮੱਸਿਆ ਹੋ ਜਾਂਦੀਆਂ ਹਨ ਜਿਹਦੇ ਕਰਕੇ ਅਸੀਂ ਉਸ ਭੋਜਨ ਨੂੰ ਬਣਾਉਣਾ ਪਸੰਦ ਹੀ ਨਹੀਂ ਕਰਦੇ ਮੈਂ ਮੈਂ ਵੀ ਕੁਛ ਅਜਿਹੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਚੁੱਕੀ ਹਾਂ ਜਿਵੇਂ ਕਿ ਮਾਸਾਹਾਰੀ ਭੋਜਨ ਦੀ ਗੱਲ ਕੀਤੀ ਜਾਵੇ ਤਾਂ ਆਂਡਾ ਆਂਡਾ ਬਣਾਉਣ ਦੇ ਸਮੇਂ ਜਿਹੜੀ ਉਹਦੀ ਖੁਸ਼ਬੂ ਆਉਂਦੀ ਹੈ ਉਹਤੋਂ ਮੈਨੂੰ ਇੰਨੀ ਐਲਰਜੀ ਹੈ ਕਿ ਮੈਂ ਉਹ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਉਹ ਮ ਮੈਨੂੰ ਇੰਨੀ ਕੁ ਉਹਦੀ ਖੁਸ਼ਬੂ ਮੇਰੇ ਨੱਕ ਨੂੰ ਚੜ ਜਾਂਦੀ ਹੈ ਕਿ ਮੈਨੂੰ ਉੱਥੋਂ ਤਾਂ ਕਿ ਕਈ ਵਾਰ ਉਲਟੀ ਤੱਕ ਆਉਣ ਦੀ ਸਮੱਸਿਆ ਵੀ ਹੋ ਆ ਜਾਂਦੀ ਹੈ ਅਤੇ ਸ਼ਾਕਾਹਾਰੀ ਭੋਜਨ ਦੇ ਵਿੱਚੋਂ ਜਿਵੇਂ ਕਿ ਅਰਬੀ ਦੀ ਗੱਲ ਕੀਤੀ ਜਾਵੇ ਅਰਬੀ ਛਿੱਲਣ ਲੱਗੇ ਸਾ ਮੈਨੂੰ ਇੰਨੀ ਸਮੱਸਿਆ ਆਉਂਦੀ ਹੈ ਕਿ ਮੇਰੇ ਹੱਥਾਂ ਦੇ ਵਿੱਚ ਇੰਨੀ ਖੁਜਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਮੈਂ ਉਹਨੂੰ ਉਹਦੇ ਨਾਲ ਮੇਰੀ ਸਾਰੀ ਚਮੜੀ ਹੀ ਲਾਲ ਹੋ ਜਾਂਦੀ ਹੈ ਕਈ ਵਾਰ ਤਾਂ ਅਜਿਹੀ ਸਮੱਸਿਆ ਆਈ ਹੈ ਕਿ ਮੈਨੂੰ ਇੰਨਾ ਮੁਸ਼ਕਿਲ ਆ ਗਈ ਕਿ ਬਾਅਦ ਚੋਂ ਮੈਨੂੰ ਕੋਈ ਕੰਮ ਕਰਨਾ ਵੀ ਕਰਨਾ ਵੀ ਔਖਾ ਹੋ ਜਾਂਦਾ ਹੈ ਇਸ ਕਰਕੇ ਅਰਬੀ ਛਿੱਲਣ ਤੋਂ ਜਾਂ ਕੱਟਣ ਤੋਂ ਪਹਿਲਾਂ ਮੈਨੂੰ ਉਸਤੇ ਆਪਣੇ ਹੱਥਾਂ ਦੇ 'ਤੇ ਸਾਰੀਆਂ ਬਾਹਵਾਂ ਦੇ ਉੱਪਰ ਸਰੋਂ ਦਾ ਤੇਲ ਲਗਾਉਣਾ ਪੈਂਦਾ ਹੈ ਤਾਂ ਕਿ ਮੈਨੂੰ ਕੋਈ ਵੀ ਐਲਰਜੀ ਨਾ ਹੋ ਸਕੇ ਅਤੇ ਅਰਬੀ ਕੱਟਦੇ ਸਮੇਂ ਮੈਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਅਤੇ ਮੈਂ ਬਹੁਤ ਹੀ ਆਸਾਨੀ ਦੇ ਨਾਲ ਅਰਬੀ ਨੂੰ ਕੱਟ ਸਕਾਂ ਇਸ ਕਰਕੇ ਹਰੇਕ ਮਨੁੱਖ ਨੂੰ ਕੋਈ ਨਾ ਕੋਈ ਖਾਣਾ ਬਣਾਉਣ ਦੇ ਸਮੇਂ ਅਜਿਹੀ ਸਮੱਸਿਆ ਆਉਂਦੀ ਹੈ ਕਿ ਜੀ ਕਰਕੇ ਉਹਨੂੰ ਕੁਛ ਐਲਰਜੀ ਹੋ ਜਾਂਦੀ ਹੈ ਜਾਂ ਫਿਰ ਅਜਿਹੀਆਂ ਪਾਬੰਦੀਆਂ ਆਉਂਦੀਆਂ ਹਨ ਜੋ ਕਿ ਉਹਨੂੰ ਖਾਣਾ ਪਕਾਉਣ ਵੇਲੇ ਕਰਨੀਆਂ ਪੈਂਦੀਆਂ ਹਨ ਪਰ ਉਹਨੂੰ ਇੱਕ ਅਜਿਹੇ ਜਿਹੀ ਮਜ਼ਬੂਰੀ ਹੋ ਜਾਂਦੀ ਆ ਉਹਨੂੰ ਕਰਨੀਆਂ ਪੈਂਦੀਆਂ ਹਨ ਪਰ ਜੇ ਅਸੀਂ ਇਹਨਾਂ ਨੂੰ ਬਹੁਤ ਹੀ ਸਹੀ ਢੰਗ ਦੇ ਨਾਲ ਜਾਂ ਉਹਨਾਂ ਦੇ ਉਪਾਵਾਂ ਨੂੰ ਦੇਖ ਕੇ ਉਹ ਖਾਣਾ ਪਕਾਉਣ ਦੀ ਤਕਨੀਕ ਨੂੰ ਅਪਣਾਇਆ ਜਾ ਸਕੇ ਤਾਂ ਮੈਨੂੰ ਲੱਗਦਾ ਹੈ ਕਿ ਹਰ ਮਨੁੱਖ ਨੂੰ ਉਹਦੇ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਕਰਕੇ ਅਸੀਂ ਅਜਿਹੀਆਂ ਭੋਜਨ ਬਣਾਉਣ ਲੱਗੇ ਅਜਿਹੀਆਂ ਪਾਬੰਦੀਆਂ 'ਤੇ ਜਰਾ ਧਿਆਨ ਨਾਲ ਸੋਚ ਵਿਚਾਰ ਕੇ ਕੰਮ ਕਰੀਏ ਤਾਂ ਸਾਡੇ ਲਈ ਸੁਖਾਲਾ ਹੋ ਸਕਦਾ ਹੈ